ਹੈਲੋ ਹਾਂਜੀ ਤੁਸੀਂ ਸਨੇਹਾ ਬੋਲ ਰਹੇ ਹੋ ਤੁਸੀਂ ਨਹਿਰੂ ਗੌਰਮਿੰਟ ਤੋਂ ਮੈਮੋਰੀਅਲ ਗੌਰਮਿੰਟ ਕੋਲਜ 'ਚ ਪੜ੍ਹਦੇ ਹੋ ਜੀ ਮੈਨੂੰ ਤੁਹਾਡਾ ਨੰਬਰ ਨਾ ਹਰਸ਼ਿਤਾ ਨੇ ਦਿੱਤਾ ਸੀਗਾ ਹਾਂਜੀ ਮੈਂ ਨਾ ਉਹ ਹੀ ਮੈਂ ਵੀ ਕੋਲਜ 'ਚ ਮਾਨਸਾ 'ਚ ਕੋਲਜ 'ਚ ਐਡਮਿਸ਼ਨ ਲੈਣਾ ਸੀਗਾ ਅਤੇ ਮੈਂ ਮੈਨੂੰ ਜਿਵੇਂ ਉੱਥੇ ਦੇ ਥੋੜ੍ਹਾ ਬਹੁਤ ਤੁਸੀਂ ਦੱਸ ਦੋਂਗੇ ਜਿਵੇਂ ਉੱਥੇ ਵੈਦਰ ਵਗੈਰਾ ਕਿਸ ਹਿਸਾਬ ਦਾ ਰਹਿੰਦਾ ਹੈ ਅਤੇ ਰਹਿਣ ਰੂਹਣ ਦਾ ਕੀ ਸਿਸਟਮ ਆ ਉੱਥੇ ਹਾਂਜੀ ਹਾਂਜੀ ਅੱਛਾ ਅੱਛਾ ਜੀ ਹਾਂਜੀ ਅੱਛਾ ਜੀ ਅਤੇ ਕੋਲਜ 'ਚ ਕਲਾਸਿਸ ਵਗੈਰਾ 'ਚ ਕੀ ਸਿਸਟਮ ਹੈ ਮਤਲਬ ਪੱਖੇ ਪੁੱਖੇ ਜਾਂ ਕੋਈ ਕੂਲਰ ਵਗੈਰਾ ਦਾ ਜਾਂ ਕੁਛ ਮਤਲਬ ਕੀ ਸਿਸਟਮ ਹੈ ਹਾਂਜੀ ਅਤੇ ਲਾਈਬ੍ਰੇਰੀ ਦੇ ਜਿਵੇਂ ਐਕਸਟਰਾ ਚਾਰਜਿਸ ਹੋਣਗੇ ਜਾਂ ਫੀਸ ਦੇ ਵਿੱਚ ਹੀ ਹੋਣਗੇ ਉਹ ਅਤੇ ਜਿਵੇਂ ਹੋਸਟਲ 'ਚ ਆਪਾਂ ਕੂਲਰ ਜਾਂ ਕੁਛ ਲੈਣਾ ਹੋਵੇ ਤਾਂ ਉਹ ਦੇ ਅਲੱਗ ਤੋਂ ਚਾਰਜਰਸ ਲੱਗਣਗੇ ਅਤੇ ਲਾਈਟ ਲੂਈਟ ਵੀ ਮਤਲਬ ਚਲੀ ਜਾਂਦੀ ਹੈ ਉੱਥੇ ਕਿਉਂਕਿ ਜਿਵੇਂ ਗਰਮੀ 'ਚ ਤਾਂ ਹੁਣ ਵੀ ਲਾਈਟ ਚਲੀ ਜਾਵੇ ਤਾਂ ਬਾਹਲੀ ਦਿੱਕਤ ਹੁੰਦੀ ਹੈ ਤਾਂ ਇੰਨਵਰਟਰ ਵਗੈਰਾ ਦਾ ਕੋਈ ਸਿਸਟਮ ਹੈਗਾ ਉੱਥੇ ਅੱਛਾ ਹਾਂ ਉਹ ਤਾਂ ਹੈ ਹੀ ਤਾਂ ਹੀ ਮੈਂ ਕਿਹਾ ਨਾ ਮੈਂ ਪਹਿਲਾਂ ਪੁੱਛ ਲਵਾਂ ਇੱਕ ਵਾਰ ਕਿਉਂਕਿ ਆਉਣ ਤੋਂ ਪਹਿਲਾਂ ਸਾਰੀ ਵੀ ਕੀ ਸਿਸਟਮ ਹੈ ਕੀ ਨਹੀਂ ਹੈ ਫਿਰ ਆਉਣ ਆਏ ਬਾਅਦ ਦਿੱਕਤ ਨਾ ਹੋਵੇ ਬਾਅਦ 'ਚ ਮਤਲਬ ਕਿ ਫਿਰ ਇੱਧਰ ਉੱਧਰ ਗਰਮੀ 'ਚ ਫਿਰਨਾ ਪਤਾ ਕਰਨਾ ਬੜਾ ਔਖਾ ਹੋ ਜਾਂਦਾ ਹਾਂ ਉਹ ਤਾਂ ਹੈ ਹੀ ਟੈਂਪਰੇਚਰ ਹੀ ਨਹੀਂ ਬਿਲਕੁੱਲ ਮਤਲਬ ਪੰਤਾਲੀ ਤੋਂ ਪੰਜਾਹ ਵਿੱਚ ਵਿਚਕਾਰ ਪਹੁੰਚਿਆ ਪਿਆ ਇਹ ਤਾਂ ਹਾਂਜੀ ਚੱਲੋ ਕੋਈ ਨਾ ਮੈਂ ਤੁਹਾਨੂੰ ਜੇ ਤੁਹਾਨੂੰ ਕੋਲਜ 'ਚ ਆਕੇ ਕੋਂਟੈਕਟ ਕਰਾਂ ਤਾਂ ਫਿਰ ਤੁਸੀਂ ਮਤਲਬ ਮਿਲ ਲਉਂਗੇ ਇੱਕ ਵਾਰ ਹਾਂਜੀ ਠੀਕ ਹੈ ਥੈਂਕ ਯੂ ਜੀ